ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਮੈਂ ਆਪਣੀ ਬੇਟੀ ਬਾਰੇ ਪੁੱਛਣਾ ਚਾਹੁੰਦੀ ਹਾਂ ਫਸਟ ਕਲਾਸ ਦੇ ਵਿੱਚ ਹੈ ਅਤੇ ਕਿ ਜਿਸ ਤਰ੍ਹਾਂ ਦੱਸਿਆ ਗਿਆ ਕਿ ਯੂਨਿਟ ਟੈਸਟ ਫਸਟ ਕੰਪਲੀਟ ਹੋ ਚੁੱਕੇ ਹਨ ਅਤੇ ਮੈਂ ਉਹਦੀ ਪਰਫੋਰਮੈਂਸ ਬਾਰੇ ਕਿ ਕਲਾਸ ਦੇ ਵਿੱਚ ਕਿਸ ਤਰ੍ਹਾਂ ਦਾ ਪਰਫੋਰਮ ਕਰਦੀ ਹੈ ਉਹਦੇ ਬਾਰੇ ਮੈਂ ਜਾਣਕਾਰੀ ਲੈਣਾ ਚਾਹੁੰਦੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਮਤਲਬ ਕਿ ਜਿਸ ਤਰ੍ਹਾਂ ਹਾਂਜੀ ਜਿਸ ਤਰ੍ਹਾਂ ਕਿ ਇਹਨਾਂ ਦੀ ਕਲਾਸ ਦੇ ਵਿੱਚ ਕੰਪੀਟੀਸ਼ਨ ਕਾਫੀ ਬੱਚਿਆਂ ਦਾ ਹੈ ਵੀ ਹਰੇਕ ਬੱਚਾ ਚਾਹੁੰਦਾ ਕਿ ਮੈਂ ਉਸ ਤੋਂ ਅੱਗੇ ਹੋਵਾਂ ਮੈਂ ਉਸ ਤੋਂ ਅੱਗੇ ਹੋਵਾਂ ਚਲੋ ਬੱਚੇ ਸਾਰੇ ਹੀ ਘਰ ਬਹੁਤ ਮਿਹਨਤ ਕਰਦੇ ਆ ਅਤੇ ਫਿਰ ਵੀ ਬੱਚੇ ਥੋੜ੍ਹਾ ਨਾ ਪੇਪਰ ਦੇ ਦੌਰਾਨ ਜਿੱਦਾਂ ਯੂਨੀਅਨ ਟੈਸਟ ਹੋ ਜਾਂਦੇ ਆ ਇਹਦੇ ਵਿੱਚ ਥੋੜ੍ਹਾ ਨਰਵਸ ਹੋ ਜਾਂਦੀ ਹੈ ਕੁਝ ਚੀਜ਼ਾਂ ਭੁੱਲ ਜਾਂਦੇ ਆ ਅਤੇ ਮਤਲਬ ਕਿ ਕੋਈ ਸਕਿਪ ਕਰ ਜਾਂਦੇ ਆ ਕਿਸੇ ਦੇ ਨੰਬ ਅਤੇ ਬੱਚੇ ਦੀ ਜਿਸ ਕਾਰਨ ਚਲੋ ਇਹਨਾਂ ਨੇ ਮਾਰਕਸ ਕੱਟ ਹੋ ਜਾਂਦੇ ਆ ਅਤੇ ਥੋੜ੍ਹੇ ਬੱਚੇ ਨਰਵਸ ਹੋ ਜਾਂਦੇ ਕਿ ਜਦੋਂ ਪੇਪਰ ਨੂੰ ਦੇਖਦੇ ਆ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਬਾਰੇ ਜਿੱਦਾਂ ਤੁਸੀਂ ਕਲਾਸ ਜਿੱਦਾਂ ਟੈਸਟ ਕਲਾਸ ਦੇ ਵਿੱਚ ਹੁੰਦੇ ਆ ਅਤੇ ਉਸ ਇਗਜ਼ਾਮ ਦੇ ਤੌਰ 'ਤੇ ਲਏ ਜਾਣ ਕਿ ਬੱਚਿਆਂ ਦੀ ਜਿਹੜੀ ਨਰਵਸਨੈਸ ਹੈ ਖ਼ਤਮ ਕੀਤੀ ਜਾਵੇ ਕਿ ਬੱਚਿਆਂ ਨੂੰ ਲੱਗੇ ਕਿ ਅਸੀਂ ਪੇਪਰ ਹੀ ਦੇ ਰਹੇ ਹਾਂ ਕਿਉਂਕਿ ਇਸ ਚੀਜ਼ ਦੇ ਬਾਰੇ ਜਿਹੜੇ ਮਾਰਕਸ ਕੱਟ ਹੋ ਜਾਂਦੇ ਉਹਨਾਂ ਦਾ ਕੋਈ ਸਲਿਊਸ਼ਨ ਨਹੀਂ ਹੈਗਾ ਕਿ ਬੱਚੇ ਨੂੰ ਆਉਂਦਾ ਵੀ ਹੋਵੇ ਅਤੇ ਬੱਚਾ ਸਕਿਪ ਕਰ ਜਾਵੇ ਜਾਂ ਛੱਡ ਜਾਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਕਿਉਂਕਿ ਐਸ ਐਸ ਟੀ ਦਾ ਸਿਲੇਬਸ ਥੋੜ੍ਹਾ ਲੈਨਥੀ ਹੁੰਦਾ ਬੱਚੇ ਨੂੰ ਡੇਟਸ ਵਗੈਰਾ ਹਿਸਟੋਰੀਕਲ ਅਤੇ ਸਿਰਫ਼ ਮਤਲਬ ਇਹ ਚੀਜ਼ਾ ਕੁਛ ਥੋੜ੍ਹਾ ਯਾਦ ਰੱਖਣ ਦੇ ਵਿੱਚ ਜਾਂ ਸਪੈਲਿੰਗ ਮਿਸਟੇਕ ਕਰ ਜਾਂਦੇ ਆ ਅਤੇ ਜਿਹਦੀ ਵਜ੍ਹਾ ਕਰਨੇ ਕਰਕੇ ਚਲੋ ਬੱਚਿਆਂ ਦੇ ਮਾਰਕਸ ਜਿਹੜੇ ਆ ਉਹ ਕੱਟੇ ਜਾਂਦੇ ਆ ਅਤੇ ਬਾਕੀ ਬੱਚੇ ਮਿਹਨਤ ਤਾਂ ਬਹੁਤ ਕਰਦੇ ਆ ਘਰ ਤਾਂ ਪੜ੍ਹਦੇ ਨਹੀਂ ਆ ਬਿਲਕੁਲ ਨਹੀਂ ਕਿਉਂਕਿ ਫੋਨ ਹੀ ਦੇਖਦੇ ਰਹਿੰਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਓ ਓਕੇ ਜੀ ਥੈਂਕ ਯੂ